ਪੰਜਾਬ 'ਚ ਸਰਕਾਰ ਛੋਟੇ ਛੋਟੇ ਵਰਗ ਦੇ ਜੇਕਰ ਲੋਕਾਂ ਵਾਸਤੇ ਕਈ ਤਰ੍ਹਾਂ ਦੀ ਸਕੀਮਾਂ ਮੁਹੱਈਆ ਕਰਦੀ ਹੈ ਜਿਵੇਂ ਕਿ ਜੇਕਰ ਸਾਨੂੰ ਸਾਡੇ ਕੋਲ ਕੋਈ ਵੀ ਚੀਜ਼ ਨਹੀਂ ਹੈ ਸਟਾਰਟ ਅਪ ਕਰਨ ਵਾਸਤੇ ਸਰਕਾਰ ਸਾਨੂੰ ਥੋੜ੍ਹੇ ਬਹੁਤੇ ਪੈਸੇ ਦਿੰਦੀ ਆ ਉਹਨੂੰ ਸਟਾਰਟ ਕਰਨ ਵਾਸਤੇ ਜਿਵੇਂ ਕਿ ਖੇਤੀਬਾੜੀ ਦੀ ਗੱਲ ਕੀਤੀ ਜਾਵੇ ਸਰਕਾਰ ਸਾਨੂੰ ਪਹਿਲਾਂ ਤਿੰਨ ਲੱਖ ਰੁਪਈਆ ਦਿੰਦੀ ਆ ਬੀਜ ਬੋਨ ਵਾਸਤੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਅਸੀਂ ਤਿੰਨ ਲੱਖ ਸਾਨੂੰ ਸਰਕਾਰ ਦਿੰਦੀ ਹੈ ਬਾਅਦ ਚੋਂ ਸਤਾਰਾਂ ਲੱਖ ਸਰਕਾਰ ਸਾਨੂੰ ਫੰਡਿੰਗ ਦਿੰਦੀ ਹੈ ਜਿਹਦੇ ਵਿੱਚ ਸਾਨੂੰ ਸਤਾ ਸਤਾਰਾਂ ਲੱਖ ਕੁਝ ਸਮੇਂ ਦੇ ਵਿੱਚ ਵਿੱਚ ਵਾਪਿਸ ਕਰਨਾ ਹੁੰਦਾ ਹੈ ਸਰਕਾਰ ਇਸੇ ਇਹਨਾਂ ਸਕੀਮਾਂ ਕਰਕੇ ਜਿਹੜਾ ਮਾੜਾ ਲੋ ਬੰਦਾ ਹੁੰਦਾ ਉਹ ਆਪਣਾ ਇਹ ਸੋਖੇ ਤਰੀਕੇ ਨਾਲ ਇੱਕ ਕੰਮ ਤਿਆਰ ਕਰ ਸਕਦਾ ਹੈ ਜਿਹਦੇ ਕਰਕੇ ਉਹ ਈਜੀਲੀ ਖਾਣ ਪੀਣ ਜੋਗਾ ਹੋ ਜਾਂਦਾ ਆਪਣੇ ਘਰ ਦੀ ਰੋਟੀ ਪਾਣੀ ਤੋਰ ਲੈਂਦਾ ਹੈ ਇਸ ਇਸੇ ਮੋਟੀਵੇਸ਼ਨ ਕਰਕੇ ਸਰਕਾਰ ਅੱਜ ਕੱਲ੍ਹ ਕਈ ਸਰਕਾਰਾਂ ਨੇ ਜਿਵੇਂ ਜਿਵੇਂ ਕਿ ਕਈ ਸਰਕਾਰਾਂ ਦੀ ਗੱਲ ਕੀਤੀ ਜਾ ਸਕੇ ਉਹਨਾਂ ਨੇ ਖੇਤੀਬਾੜੀ ਸਕੀਮ ਐਗਰੀਕਲਚਰ ਸਕੀਮ ਕਈ ਤਰ੍ਹਾਂ ਦੀ ਸਕੀਮ ਸਟਾਰਟ ਕੀਤੀ ਹੋਈ ਹੈ ਜਿਸ ਜਿਸ ਕਰਕੇ ਇਸ ਕਰਕੇ ਸਾਨੂੰ ਇਸ ਕਰਕੇ ਸਾ ਉਹਨਾਂ ਨੂੰ ਰਹਿਣ ਸਹਿਣ ਵਿੱਚ ਕੋਈ ਔਖ ਨਹੀਂ ਹੋ ਰਹੀ ਨਾਲੇ ਉਹ ਬਹੁਤ ਹੀ ਵਧੀਆ ਰਹਿਣ ਸਹਿਣ ਕਰ ਪਾ ਰਹੇ ਨੇ ਆਪਣਾ ਅਤੇ ਹੌਲੀ ਹੌਲੀ ਆਪਣਾ ਕਰਜ਼ਾ ਵੀ ਲਾਈ ਜਾਂਦੇ ਨੇ ਜੇ ਪੋਲਿਸੀਆਂ ਦੀ ਗੱਲ ਕੀਤੀ ਜਾਵੇ ਪੋਲਿਸੀ ਸਰਕਾਰ ਬਹੁਤ ਹੀ ਦਿੰਦੀਆਂ ਨੇ ਇਸ ਇਸ ਨੂੰ ਆਪਾਂ ਜੇ ਚੰਗੇ ਤਰੀਕੇ ਨਾਲ ਇਸ ਨੂੰ ਦੇਖਿਆ ਜਾਵੇ ਕਈ ਲੋਕ ਤਾਂ ਕਰਦੇ ਹਨ ਕਿ ਉਹਨਾਂ ਨੂੰ ਪੋਲਸੀਆਂ ਨੂੰ ਖਾ ਜਾਂਦੇ ਨੇ ਪਰ ਕਈ ਇਹਨਾਂ ਨੂੰ ਬਹੁਤ ਵਧੀਆ ਯੂਜ ਕਰਦੇ ਨੇ ਜਿਸ ਕਰਕੇ ਉਹ ਕਿਤੇ ਉੱਚੇ ਪੱਧਰ 'ਤੇ ਪਹੁੰਚ ਜਾਂਦੇ